ਮੁੱਦਿਆਂ ਅਤੇ ਸਮੱਸਿਆ ਦਾ ਬੜਾ ਜ਼ੋਰ ਦਿੰਦਾ ਹੁੰਦਾ ਕਈ ਮੁੱਦੇ ਧਿਆਨ ਦੇਣਾ ਯੋਗ ਦੇ ਵਿੱਚ ਜਿਵੇਂ ਕਿ ਸਾਨੂੰ ਕਈ ਸਮੱਸਿਆਵਾਂ ਆਈਆਂ ਆਉਂਦੀਆਂ ਪੰਜਾਬ ਦੇ ਵਿੱਚ ਕਈ ਸਮੱਸਿਆ ਕਸਟਮਰ ਦੇ ਹਰੇਕ ਡਮਾਡਾਂ ਅੱਡ ਅੱਡ ਹੁੰਦੀਆਂ ਨੇ ਜਿਵੇਂ ਮੌਸਮ ਦੇ ਹਿਸਾਬ ਨਾਲ ਕਾਫੀ ਚੇਂਜ ਹੋਣਾ ਪੈਂਦਾ ਗਰਮੀ ਵੀ ਬ ਬਥੇਰੀ ਪੈਂਦੀ ਆ ਠੰਡ ਵੀ ਹੁੰਦੀ ਹੈ ਤਾਂ ਮੌਸਮ ਦੇ ਹਿਸਾਬ ਨਾਲ ਕੱਪੜਿਆਂ ਦਾ ਚੇਂਜ ਚੂੰਜ ਕਰਨਾ ਪੈਂਦਾ ਹੁੰਦਾ ਵਾ ਅਤੇ ਜਿਵੇਂ ਕਿ ਸਰਦੀਆਂ ਦੇ ਵਿੱਚ ਕੱਪੜੇ ਵਾਲਾ ਧਿਆਨ ਜਿਹੜਾ ਦੁਕਾਨਦਾਰ ਕਸਟਮਰਾਂ ਦੇ ਹਰੇਕ ਤਰ੍ਹਾਂ ਦੇ ਕਸਟਮਰ ਦੀ ਚੋਇਸ ਅੱਡ ਅੱਡ ਕਲਰਾਂ ਦੀ ਹੁੰਦੀ ਹੈ ਅੱਡ ਅੱਡ ਤਰ੍ਹਾਂ ਦੀ ਹੁੰਦੀ ਹੈ ਕੋਈ ਸ ਕੱਪੜੇ ਕੋਈ ਕਿਸ ਤਰ੍ਹਾਂ ਦੇ ਪਾਉਂਦੇ ਨੇ ਕੋਈ ਕਿਸ ਤਰ੍ਹਾਂ ਦੀ ਸਰਦੀਆਂ ਦੇ ਵਿੱਚ ਕੋਟੀਆਂ ਸਵੈਟਰਾਂ ਦੇ ਅਲੱਗ ਅਲੱਗ ਤਰ੍ਹਾਂ ਦੀ ਸਵੈਟਰ ਹੁੰਦੇ ਹਨ ਟਾਸ ਅੱਡ ਹੁੰਦੇ ਹਨ ਅਤੇ ਜਿਹੜੀ ਆਪਣੇ ਬਹੁਤ ਧਿਆਨ ਦੇਣਾ ਪੈਂਦਾ ਹੈ ਅਤੇ ਉਹਨਾਂ ਦੇ ਯੋਗ ਦੇਖਦੇ ਹੋਏ ਕਸਟਮਰ ਨੂੰ ਹਰੇਕ ਦੇਣੀ ਪੈਂਦੀ ਹੈ ਕੱਪੜਾ ਹੋ ਗਿਆ ਅਤੇ ਕੱਪੜੇ ਦੇਖਣੇ ਪੈਂਦੇ ਆ ਧਿਆਨ ਨਾਲ